ਪਸ਼ੂਆਂ ਦੀਆਂ ਬਿਮਾਰੀਆਂ ਵਿੱਚ ਜਿਵੇਂ ਮੂੰਹ ਖੁਰ ਦੀ ਬਿਮਾਰੀ ਇਹਦੇ ਵਿੱਚ ਪਸ਼ੂ ਨਾ ਖਾਣਾ ਖਾਣਾ ਮਤਲਬ ਕਿ ਚਾਰਾ ਖਾਣਾ ਬੰਦ ਕਰ ਦਿੰਦਾ ਬਿਲਕੁਲ ਸੁਸਤ ਹੋ ਜਾਂਦਾ ਅਤੇ ਜਿਸ ਨੂੰ ਮੂੰਹ ਖੁਰ ਦੀ ਬਿਮਾਰੀ ਕਹਿੰਦੇ ਨੇ ਇਹਦਾ ਇਲਾਜ ਡਾਕਟਰ ਦੁਆਰਾ ਹੀ ਕਰਵਾਇਆ ਜਾਂਦਾ ਹੈ ਦੋ ਰੋਮੈਟਿਕਸ ਦੋ ਬਿਮਾਰੀਆਂ ਹਨ ਜਿਹਨਾਂ ਨੂੰ ਅਖਬਾਰ ਖਤਮ ਕਰਨ ਲਈ ਆਖਰਕਾਰ ਖਤਮ ਕਰਨ ਲਈ ਕੰਮ ਕੀਤਾ ਜਾਂਦਾ ਹੈ ਦੋਵੇਂ ਬਿਮਾਰੀਆਂ ਕਿਸਾਨਾਂ ਲਈ ਆਰਥਿਕ ਮਹੱਤਵ ਹਨ ਐਫ ਡੀ ਐਮ ਆਦਿ ਬਿਮਾਰੀਆਂ ਨੂੰ ਬ ਪਸ਼ੂਆਂ ਨੂੰ ਲਕੂਅਡ ਪਿਆਇਆ ਜਾਂਦਾ ਕੈਲਸ਼ੀਅਮ ਦਿੱਤਾ ਜਾਂਦਾ ਜਿਹਦੇ ਨਾਲ ਹੌਲੀ ਹੌਲੀ ਉਹਨਾਂ ਨੂੰ ਆਰਾਮ ਮਿਲ ਜਾਂਦਾ ਅਤੇ ਇਹਦੇ ਵਿੱਚ ਮੂੰਹ ਖ਼ੁਰ ਦੀ ਬਿਮਾਰੀ ਵਿੱਚ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਹੈ ਅਤੇ ਬੁਖਾਰ ਵੀ ਹੋ ਜਾਂਦਾ ਇਹਦੇ ਵਿੱਚ ਪਸ਼ੂ ਨੂੰ ਪਾਣੀ ਨਾਲ ਨਵਾਉਣਾ ਨਹੀਂ ਚਾਹੀਦਾ ਕਿਉਂਕਿ ਪਸ਼ੂ ਬਿਲਕੁਲ ਜੁੜ ਜਾਂਦਾ ਅਤੇ ਦੁੱਧ ਦੇਣਾ ਬੰਦ ਕਰ ਦਿੰਦਾ ਖਾਣਾ ਖੁਣਾ ਬਿਲਕੁਲ ਸੁਸਤ ਹੋ ਜਾਂਦਾ ਕਈ ਵਾਰ ਹਾਲਾਤ ਇੱਥੇ ਤੱਕ ਪਹੁੰਚ ਜਾਂਦੇ ਨੇ ਕਿ ਪਸ਼ੂ ਦੀ ਮੌਤ ਵੀ ਹੋ ਜਾਂਦੀ ਹੈ ਪਸ਼ੂ ਇੰਨਾ ਜ਼ਿਆਦਾ ਤੰਗ ਹੋਣ ਕਰਕੇ